ਸਭ ਤੋਂ ਵੱਡੀ ਟੈਕਨੋਲੋਜੀ ਹੈ ਮੋਬਾਈਲ ਫੋਨ ਦੀ ਮੋਬਾਇਲ ਫੋਨ ਦੇ ਉੱਤੇ ਤੁਸੀਂ ਹਰ ਪ੍ਰਕਾਰ ਦਾ ਮਨੋਰੰਜਨ ਵੇਖ ਸਕਦੇ ਹੋ ਕਰ ਸਕਦੇ ਹੋ ਜਿਵੇਂ ਦੂਰ ਦੋਰਾਜ ਇਲਾਕੇ ਹੀ ਯੂਟੀਊਬ 'ਤੇ ਵੇਖੇ ਜਾ ਸਕਦੇ ਹਨ ਗਾਣੇ ਹੋਰ ਲੋਕਾਂ ਦੀਆਂ ਰਹਿਣ ਸਹਿਣ ਦ ਦੇਖ ਸਕਦੇ ਹਾਂ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਕਲਚਰ ਵੇਖ ਸਕਦੇ ਹਾਂ ਇਹ ਜੋ ਕਿ ਇਹ ਤਾਂ ਪਹਿਲਾਂ ਨਹੀਂ ਸਨ ਅੱਜ ਸਾਨੂੰ ਇਹ ਇੱਕ ਆਪਣੇ ਈਜੀ ਤਰੀਕੇ ਨਾਲ ਉਪਲੱਬਧ ਹਨ